ਸਾਡੇ ਪਰਿਵਾਰ ਵਿੱਚ ਹਰ ਸਾਲ ਦਿਵਾਲੀ 'ਤੇ ਅਸੀਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਾਂਦੇ ਹਾਂ ਅਤੇ ਉੱਥੇ ਦਰਸ਼ਨ ਕਰਦੇ ਹਾਂ ਇਹ ਪਰੰਪਰਾ ਸਾਡੇ ਪਰਿਵਾਰ ਵਿੱਚ ਬਹੁਤ ਸਮੇਂ ਤੋਂ ਚਲਦੀ ਆ ਰਹੀ ਹੈ ਅਸੀਂ ਇਸ ਦਿਨ ਸਾਰੇ ਪਰਿਵਾਰ ਨੇ ਹਰ ਹਾਲਤ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਹੀ ਹਨ